ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਸ਼ਾਹੀ ਢਾਬਾ ਪਟਿਆਲਾ ਤੋਂ ਗੱਲ ਕਰ ਰਹੇ ਹੋ ਹਾਂਜੀ ਅਸੀਂ ਬੈਂਕ ਕਲੋਨੀ ਪਟਿਆਲਾ ਤੋਂ ਗੱਲ ਕਰ ਰਹੇ ਹਾਂ ਸਾਨੂੰ ਸਾਗ ਮੱਕੀ ਦੀ ਰੋਟੀ ਅਤੇ ਖੀਰ ਚਾਹੀਦੀ ਹੈ ਕੀ ਇਹ ਤਿੰਨੋਂ ਪਕਵਾਨ ਤੁਹਾਡੇ ਕੋਲ ਉਪਲੱਬਧ ਹੋਣਗੇ ਹਾਂਜੀ ਅਤੇ ਇਹਨਾਂ ਦੇ ਕੀ ਰੇਟ ਹੋਣਗੇ ਤਿੰਨ ਸੌ ਰੁਪਿਆ ਜਿਵੇਂ ਕਿ ਅੱਜ ਨੌ ਜਨਵਰੀ ਦਿਨ ਮੰਗਲਵਾਰ ਹੈ ਕੀ ਮੰਗਲਵਾਰ ਦੇ ਦਿਨ ਤੁਹਾਡੇ ਕੋਲ ਕੁਛ ਅਲੱਗ ਛੂਟ ਹੁੰਦੀ ਹੈ ਹਾਂਜੀ ਸਾਨੂੰ ਇਹ ਢਾਈ ਸੌ ਰੁਪਏ ਦੀ ਲੱਗ ਜਾਵੇਗੀ ਠੀਕ ਹੈ ਜੀ ਅਤੇ ਤੁਸੀਂ ਸਾਨੂੰ ਇਹ ਤਿੰਨੋਂ ਚੀਜ਼ਾਂ ਕਿੰਨੀ ਦੇਰ ਦੇ ਵਿੱਚ ਉਪਲੱਬਧ ਕਰਵਾ ਸਕਦੇ ਹੋ ਕਿਉਂਕਿ ਸਾਨੂੰ ਇਹ ਅੱਧੇ ਘੰਟੇ ਦੇ ਵਿੱਚ ਤਿੰਨੋਂ ਪਕਵਾਨ ਨੇ ਜਿਹੜੇ ਬੈਂਕ ਕਲੋਨੀ ਦੇ ਵਿੱਚ ਉਪਲੱਬਧ ਹੋਣੇ ਚਾਹੀਦੇ ਆ ਠੀਕ ਹੈ ਜੀ ਅਤੇ ਅਸੀਂ ਇਸਦੀ ਪੇਮੈਂਟ ਹੈ ਜਿਹੜੀ ਗੂਗਲ ਪੇਅ ਦੇ ਰਾਹੀਂ ਤੁਹਾਨੂੰ ਕਰ ਦੇਵਾਂਗੇ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ